ਸਤਿ ਸ਼੍ਰੀ ਅਕਾਲ ਖੇਡਾਂ ਸਾਨੂੰ ਕਾਫੀ ਕੁਝ ਸਿਖਾਉਂਦੀਆਂ ਹਨ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿ ਮੇਰੇ ਹਿਸਾਬ ਨਾਲ ਖੇਡਾਂ ਵਿੱਚ ਸਾਰੀਆਂ ਕੌਮਾਂ ਅਤੇ ਸਾਰੇ ਸਮੂਹਾਂ ਦੇ ਵਿਚਾਰ ਸ਼ਾਂਤੀ ਅਤੇ ਸ਼ਬਦ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਬਹੁਤ ਵੱਡਾ ਰੋਲ ਨਿਭਾਉਂਦੀਆਂ ਹਨ ਦੇਖਿਆ ਜਾਏ ਤਾਂ ਇਸ ਖੇਡਾਂ ਸਾਨੂੰ ਸਾਰਿਆਂ ਨੂੰ ਇਕੱਠੇ ਰੱਖਦੀਆਂ ਹਨ ਕਿਉਂਕਿ ਕੋਈ ਵੀ ਜਾਤ ਦਾ ਕੋਈ ਵੀ ਕੌਮ ਦਾ ਬੰਦਾ ਹੈ ਜਦੋਂ ਸਾਡੇ ਦੇਸ਼ ਨੂੰ ਉਸ ਖੇਡ 'ਤੇ ਰੀਪ੍ਰਜੈਂਟ ਕਰ ਰਿਹਾ ਹੈ ਤਾਂ ਸਾਰੇ ਇਕੱਠੇ ਹੁੰਦੇ ਹਨ ਅਤੇ ਸਾਡੇ ਦੇਸ਼ ਨੂੰ ਸਪੋਰਟ ਕਰਦੇ ਹਨ ਦੂਜੀ ਗੱਲ ਆਈ ਕਿ ਸਾਡੀ ਕੁਝ ਪ੍ਰੀਵੈਸ਼ਨ ਵੀ ਹੁੰਦੀ ਹੈ ਕੋਨਫਲਿੱਕਟ ਪ੍ਰੀਵੈਸ਼ਨ ਯਾਨੀ ਕਿ ਲੜਾਈਆਂ ਵੀ ਘੱਟ ਹੁੰਦੀਆਂ ਹਨ ਇਹਦੇ ਕਰਕੇ ਅਤੇ ਉਸ ਤੋਂ ਬਾਅਦ ਸਾਡੀ ਰਿਸੋਰਸ ਦੀ ਡਿਵਲੈਪਮੈਂਟ ਵੀ ਹੁੰਦੀ ਹੈ ਇਹਦਾ ਮਤਲਬ ਕਿ ਜਿਸ ਕਰਕੇ ਸਾਡਾ ਜੇ ਦੇਸ਼ ਜਿੱਤਦਾ ਹੈ ਅਤੇ ਉਹਨੂੰ ਕਾਫੀ ਜ਼ਿਆਦਾ ਲੋਕ ਦੇਖਦੇ ਹਨ ਅਤੇ ਸਾਡੇ ਦੇਸ਼ ਦੀ ਤਰੱਕੀ ਵੀ ਹੁੰਦੀ ਹੈ ਜੋ ਕਿ ਹੋਰ ਅਤੇ ਹੋਰ ਲੋਕ ਉਸ ਸਪੋਰਟਸ ਵਿੱਚ ਆਉਂਦੇ ਹਨ ਉਸ ਤੋਂ ਬਾਅਦ ਸਾਡਾ ਦੇਸ਼ ਤਰੱਕੀ ਵੀ ਬਹੁਤ ਜ਼ਿਆਦਾ ਕਰਦਾ ਹੈ ਸਾਨੂੰ ਰੈਜੋਲਊਸ਼ਨ ਵੀ ਮਿਲਦੇ ਹਨ ਇਹਦਾ ਮਤਲਬ ਕਿ ਫਿਰ ਲੋਕ ਹਰ ਸਾਲ ਲਈ ਨਵੇਂ ਨਵੇਂ ਸਪੋਰਟਸ ਟਰਾਈ ਕਰਦੇ ਹਨ ਲੋਕ ਦੇਖਿਆ ਜਾਏ ਤਾਂ ਖੇਡਾਂ ਨਾਲ ਇੱਕ ਇਹ ਵੀ ਫਾਇਦਾ ਚੁੱਕਦੇ ਹਨ ਕਿ ਖੇਡਾਂ ਨਾਲ ਉਹਨਾਂ ਨੂੰ ਡਿਸਿਪਲਿਨ ਆ ਜਾਂਦਾ ਹੈ ਜਿਹਨੂੰ ਇਹ ਕਹਿ ਸਕਦੇ ਹਾਂ ਕਿ ਉਹ ਹਰ ਕਿਸੇ ਨਾਲ ਇਕੁਇਲੀ ਬਿਲੀਵ ਇਕੁਐਲਟੀ ਵਿੱਚ ਬਿਲੀਵ ਕਰਦੇ ਹਨ ਜਾਂ ਕਹਿ ਸਕਦੇ ਬਿਲਕੁਲ ਨੋਰਮਲ ਵੇ ਨਾਲ ਗੱਲ ਕਰਦੇ ਹਨ ਡਿਸਿਪਲੀਨ ਵਿੱਚ ਇਹ ਕਹਿਣਾ ਚਾਹਾਂਗਾ ਕਿ ਲੋਕ ਜਿਹੜੇ ਇੱਕ ਪਾਸੇ ਆਪਣਾ ਧਿਆਨ ਕੇਂਦਰਿਤ ਕਰਦੇ ਹਨ ਸਿਰਫ ਇੱਕੋ ਹੀ ਚੀਜ਼ 'ਤੇ ਫੋਕਸ ਕਰਦੇ ਹਨ ਨਾ ਕਿਤੇ ਇੱਧਰ ਭਟਕਦੇ ਹਨ ਨਾ ਕਿਤੇ ਉੱਧਰ ਭਟਕਦੇ ਹਨ ਇਹ ਡਿਸਪਲਨ ਸਪੋਰਟਸ ਸਾਨੂੰ ਬੜੇ ਚੰਗੇ ਤਰੀਕੇ ਨਾਲ ਸਿਖਾਉਂਦੀ ਹੈ ਕਿਉਂਕਿ ਜੇ ਤੁਸੀਂ ਸਪੋਰਟਸ ਵਿੱਚ ਜਾਂ ਖੇਡਾਂ ਵਿੱਚ ਸਕਸੈਸਫੁਲ ਜਾਂ ਕ ਕਿਹਾ ਜਾਏ ਕਿ ਤੁਸੀਂ ਖੇਡਾਂ ਵਿੱਚ ਸਫ਼ਲਤਾ ਹਾਸਲ ਕਰਨੀ ਹੈ ਤਾਂ ਸਾਨੂੰ ਡਿਸਪਲਨ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਹੈ